ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਤਰਨ ਤਾਰਨ ਤੋਂ ਸਟੇਸ਼ਨ ਮਾਸਟਰ ਗੱਲ ਕਰ ਰਿਹਾ ਹਾਂਜੀ ਜ਼ਰੂਰ ਜੀ ਦੱਸੋ ਹਾਂਜੀ ਤਰਨ ਤਾਰਨ ਤੋਂ ਭੱਟੀ ਨੂੰ ਵੀ ਟਰੇਨ ਜਾਂਦੀ ਹੈ ਤਰਨ ਤਾਰਨ ਤੋਂ ਅੰਮ੍ਰਿਤਸਰ ਨੂੰ ਵੀ ਟਰੇਨ ਚੱਲਦੀ ਹੈ ਹਾਂਜੀ ਤਰਨ ਤਾਰਨ ਤੋਂ ਟਰੇਨਾਂ ਤਕਰੀਬਨ ਇੱਕ ਡੇਢ ਘੰਟੇ ਦੇ ਵਕਫੇ ਦੇ ਨਾਲ ਚੱਲਦੀਆਂ ਰਹਿੰਦੀਆਂ ਨੇ ਤੁਸੀਂ ਜਦੋਂ ਵੀ ਵਿਜਿਟ ਕਰੋਗੇ ਤੁਹਾਨੂੰ ਉਹ ਸਮਾਂ ਸਾਰਨੀ ਜਿਹੜੀ ਹੈ ਤੁਸੀਂ ਪਤਾ ਕਰ ਸਕਦੇ ਹੋ ਨਹੀਂ ਜੀ ਤੁਹਾਨੂੰ ਤਰਨ ਤਾਰਨ ਤੋਂ ਵਾਇਆ ਅੰਮ੍ਰਿਤਸਰ ਹੋ ਕੇ ਜਲੰਧਰ ਲੁਧਿਆਣਾ ਤੁਸੀਂ ਜਾ ਸਕਦੇ ਜੇ ਤਰਨ ਤਾਰਨ ਤੋਂ ਟਰੇਨਾਂ ਚੱਲਦੀਆਂ ਹੈ ਜਲੰਧਰ ਨੂੰ ਲੁਧਿਆਣੇ ਨੂੰ ਹਾਂਜੀ ਹਾਂਜੀ ਤਰਨ ਤਾਰਨ ਤੋਂ ਹੀ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਏਗੀ ਤੁਹਾਨੂੰ ਪ੍ਰੋਪਰ ਸਾਡੇ ਜਿਹੜੇ ਆ ਟਿਕਟ ਚੈਕਰ ਨੇ ਟਿਕਟਾਂ ਕੱਟਣ ਵਾਲੇ ਨੇ ਉਹ ਤੁਹਾਨੂੰ ਜਾਣਕਾਰੀ ਉਹਨਾਂ ਤੋਂ ਤੁਸੀਂ ਲੈ ਸਕਦੇ ਜੀ ਹਾਂਜੀ ਤੁਸੀਂ ਔਨਲਾਈਨ ਵੀ ਬੁੱਕ ਕਰ ਸਕਦੇ ਜੇ ਜੇਕਰ ਤੁਸੀਂ ਇੱਥੇ ਮੌਕੇ 'ਤੇ ਟਿਕਟ ਲੈਣੀ ਹੈ ਉਹ ਤਤਕਾਲ ਦੇ ਵਿੱਚ ਵੀ ਟਿਕਟ ਬੁੱਕ ਹੋ ਜਾਏਗੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ